ਮੀਡੀਆ ਦੇ ਵਿੱਚ ਜਿਹੜੇ ਇਸ਼ਤਿਹਾਰ ਨੇ ਕਈ ਤਰ੍ਹਾਂ ਦੇ ਦਿਖਾਏ ਜਾਂਦੇ ਨੇ ਉਹ ਕਦੇ ਨਿਊਜ਼ ਪੇਪਰ ਦੇ ਵਿੱਚ ਹੁੰਦੇ ਨੇ ਕਦੇ ਸੋਸ਼ਲ ਮੀਡੀਆ ਦੇ ਥਰੂ ਉਹ ਪ੍ਰਚਾਰ ਕਰ ਰਹੇ ਹੁੰਦੇ ਨੇ ਕਦੇ ਮਸ਼ਹੂਰੀਆਂ ਦੇ ਥਰੂ ਅਤੇ ਉਹਦੇ ਵਿੱਚ ਕ ਕਈ ਲਾਭਦਾਇਕ ਵੀ ਹੁੰਦੇ ਨੇ ਅਤੇ ਕਈ ਆਪਾਂ ਨੂੰ ਭਟਕਾਉਣ ਦਾ ਕੰਮ ਵੀ ਕਰਦੇ ਨੇ ਅਤੇ ਉਹ ਕਈ ਤਰ੍ਹਾਂ ਦੇ ਹੁੰਦਾ ਕਿ ਲਾ ਲਾਭਦਾਇਕ ਇਵੇਂ ਹੁੰਦੇ ਨੇ ਜਿਵੇਂ ਕੋਈ ਨਵਾਂ ਪ੍ਰੋਡਕਟ ਅਗਰ ਆਪਣੇ ਮਾਰਕੀਟ ਦੇ ਵਿੱਚ ਆਇਆ ਹੈ ਅਤੇ ਉਹਨੂੰ ਜਿਹੜਾ ਉਸ ਤੋਂ ਉਸ ਪ੍ਰੋਡਕਟ ਤੋਂ ਸਾਨੂੰ ਬਹੁਤ ਲਾਭ ਮਿਲਦਾ ਹੈ ਅਤੇ ਆਪਾਂ ਜਿਹੜਾ ਹੈਗਾ ਉਹਦੇ ਥਰੂ ਥੋੜ੍ਹਾ ਅਵੇਅਰ ਹੋ ਸਕਦੇ ਹਾਂ ਕਿ ਇਹ ਪ੍ਰੋਡਕਟ ਸਾਡੇ ਮ ਮਾਰਕੀਟ ਦੇ ਵਿੱਚ ਹੈਗਾ ਅਤੇ ਅਸੀਂ ਇਹਨੂੰ ਲੈ ਸਕਦੇ ਹਾਂ ਅਤੇ ਆਪਣੀ ਜਿਹੜੀ ਸਹੂਲਤ ਹੈ ਉਹਦੇ ਲਈ ਆਪਾਂ ਇਹਨੂੰ ਯੂਜ ਕਰ ਸਕਦੇ ਹਾਂ ਪਰ ਲੇਕਿਨ ਕਦੇ ਕਦੇ ਉਹ ਜਿਹੜੇ ਪ੍ਰੋਡਕਟ ਨੇ ਉਹ ਤੁਹਾਨੂੰ ਜਿਵੇਂ ਦਿਖਾਏ ਜਾਂਦੇ ਨੇ ਉਹ ਉੱਦਾਂ ਦੇ ਨਹੀਂ ਨਿਕਲਦੇ ਹੈਗੇ ਅਤੇ ਜਦੋਂ ਅਸੀਂ ਆਪਾਂ ਨੂੰ ਉਹਨਾਂ ਨੂੰ ਯੂਜ ਕਰਦੇ ਹਾਂ ਆਪਾਂ ਨੂੰ ਪਤਾ ਲੱਗਦਾ ਕਿ ਇੱਦਾਂ ਦੇ ਕਈ ਮਤਲਬ ਇਹਨਾਂ ਦੇ ਕਈ ਹਾਨੀਕਾਰਕ ਪ੍ਰਭਾਵ ਵੀ ਨੇ ਪਰ ਉਹ ਆਪਾਂ ਨੂੰ ਦੱਸੇ ਨਹੀਂ ਜਾਂਦੇ ਹੈਗੇ ਜਿਵੇਂ ਮੈਂ ਇਗਜ਼ੈਮਪਲ ਦੇਣਾ ਚਾਹੂੰਗੀ ਏ ਸੀ ਹੈ ਏ ਸੀ ਆਪਾਂ ਨੂੰ ਦੱਸਦੇ ਨੇ ਕਿ ਗਰਮੀ ਦੇ ਵਿੱਚ ਆਪਾਂ ਕਿਵੇਂ ਆਪਣੀ ਜਿਹੜੀ ਜ਼ਿਆਦਾ ਗਰਮ ਜਿਹੜੀ ਹਵਾ ਆ ਜਾਂ ਫਿਰ ਜ਼ਿਆਦਾ ਗਰਮੀ ਆ ਉਹ ਤੋਂ ਕਿਵੇਂ ਬਚ ਸਕਦੇ ਹਾਂ ਪਰ ਲੇਕਿਨ ਸਾਨੂੰ ਇਹਦੇ ਬਾਰੇ ਨਹੀਂ ਦੱਸਿਆ ਜਾਂਦਾ ਉਹਦੇ ਵਿੱਚ ਕਿ ਜਿਹੜਾ ਏ ਸੀ ਹੈ ਉ ਉਹਦਾ ਪ੍ਰਭਾਵ ਜਿਹੜਾ ਹੈਗਾ ਆਪਣੇ ਵਾਤਾਵਰਨ 'ਤੇ ਬੜਾ ਹੀ ਹਾਨੀਕਾਰਕ ਹੈ ਅਤੇ ਜਿਹੜੀ ਓਜ਼ੋਨ ਲੇਅਰ ਹੈ ਇਹਦੇ ਨਾਲ਼ ਉਹਨੂੰ ਨੁਕਸਾਨ ਪਹੁੰਚ ਸਕਦਾ ਜਿਹਦੇ ਕਰਕੇ ਸਾਨੂੰ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਚਮੜੀ ਦੇ ਕੈਂਸਰ ਜਾਂ ਫਿਰ ਕਈ ਤਰ੍ਹਾਂ ਦੇ ਹੋਰ ਰੋਗ ਹੋ ਸਕਦੇ ਹਨ